ਪੰਜਾਬੀ ਸੱਭਿਆਚਾਰ 'ਚ ਪਰੰਪਰਾਵਾਂ ਨੂੰ ਮਨਾਉਣ ਲਈ ਪੰਜਾਬੀ ਬੋਲੀ ਦਾ ਇੰਮਪੋਰਟੈਂਟ ਰੋਲ ਹੈ ਪੰਜਾਬੀ ਬੋਲੀ ਦੇ ਥਰੂ ਹੀ ਪੰਜਾਬੀ ਲੋਕ ਆਪਣੇ ਅਲੱਗ ਅਲੱਗ ਤਿਉਹਾਰ ਜਾਂ ਖਾਸ ਖਾਸ ਮੌਕਿਆਂ 'ਤੇ ਇਸ ਨੂੰ ਯੂਜ ਕਰਦੇ ਹੈ ਜਨਮ 'ਤੇ ਜਾਂ ਮਰਨ 'ਤੇ ਜਾਂ ਕੋਈ ਹੋਰ ਵੀ ਕੋਈ ਵੀ ਖਾਸ ਮੌਕਿਆਂ 'ਤੇ ਪੰਜਾਬੀ ਲੋਕ ਜਾਂ ਤਿਉਹਾਰਾਂ 'ਤੇ ਆਪਣੇ ਲੋਕ ਗੀਤ ਬੋਲੀਆਂ ਘੋੜੀਆਂ ਜਾਂ ਲੋਕ ਕਥਾਵਾਂ ਇਹਨਾਂ ਦਾ ਹੀ ਵਰਤੋਂ ਕਰਦੇ ਹਨ ਇਹਨਾਂ ਸਾਰਿਆਂ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਥਰੂ ਹੀ ਹੁੰਦੀ ਹੈ ਅਤੇ ਪੰਜਾਬੀ ਭਾਸ਼ਾ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਦੀ ਕੋਈ ਇੰਮਪੋਰਟੈਂਸ ਨਹੀਂ ਰਹਿ ਜਾਂਦੀ ਹੈ ਇਸ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਦੀ ਕੋਈ ਹੋਂਦ ਨਹੀਂ ਹੋਂਦ ਨਹੀਂ ਹੈ ਪੁਰਾਣੇ ਜ਼ਮਾਨਿਆਂ ਵਿੱਚ ਲੋਕ ਲੋਕ ਕਥਾਵਾਂ ਦਾ ਗੀਤ ਖੁਦ ਗਾਉਂਦੇ ਸੀ ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਹ ਰਿਕੋਡਿਡ ਯੂਜ ਕਰਦੇ ਹਨ ਜਿੱਥੇ ਜਦ ਕਿ ਪੁਰਾਣੇ ਜ਼ਮਾਨਿਆਂ ਵਿੱਚ ਲੋਕ ਆਪ ਗਾਉਂਦੇ ਸੀ ਪਰ ਅ ਅੱਜ ਕੱਲ੍ਹ ਲੋਕ ਪਹਿਲਾਂ ਤੋਂ ਹੀ ਰਿਕੋਡ ਕੀਤੇ ਹੋਏ ਕਲਾਕਾਰਾਂ ਦੇ ਗੀਤ ਉਹ ਲਗਾਉਂਦੇ ਹਨ ਅਤੇ ਪੰਜਾਬੀ ਨੂੰ ਐਕਸਪ੍ਰੈਸ ਕਰਦੇ ਹਨ